ਹਾਂਜੀ ਮੇਰੇ ਕੋਲ ਮੇਰੇ ਵਿਦਿਆਰਥੀ ਕਾਫ਼ੀ ਮੇਰੇ ਤੋਂ ਸਲਾਹ ਵਗੈਰਾ ਲੈਂਦੇ ਰਹਿੰਦੇ ਨੇ ਅ ਪੜ੍ਹਨ ਲਿਖਣ ਲਈ ਕਈ ਵਿਦਿਆਰਥੀਆਂ ਨੂੰ ਕਵਿਤਾ ਦਾ ਲਿ ਸ਼ੌਕ ਹੈ ਲਿਖਣ ਦਾ ਕਈਆਂ ਨੂੰ ਕਹਾਣੀਆਂ ਲਿਖਣ ਦਾ ਸ਼ੌਕ ਹੈਗਾ ਉਹ ਸਾਰੇ ਮੇਰੇ ਨਾਲ ਸੰਪਰਕ 'ਚ ਰਹਿੰਦੇ ਨੇ ਲਿਖਦੇ ਰਹਿੰਦੇ ਨੇ ਕਵਿਤਾਵਾਂ ਵਗੈਰਾ ਅਤੇ ਕਹਾਣੀਆਂ ਵਗੈਰਾ ਮੈਂ ਵੀ ਆਪਣੇ ਵੱਡਿਆਂ ਤੋਂ ਆਪਣੇ ਦੋਸਤਾਂ ਤੋਂ ਲਿਖਣ ਦੇ ਸੰਬੰਧ ਦੇ ਵਿੱਚ ਗੱਲ ਬਾਤ ਕਰਦਾ ਰਹਿੰਦਾ ਮੈਨੂੰ ਵੀ ਥੋੜ੍ਹਾ ਬਹੁਤ ਸ਼ਾਇਰੀ ਲਿ ਲਿਖਣ ਦਾ ਸ਼ੌਕ ਹੈ ਅਤੇ ਮੇਰੇ ਦੋਸਤ ਵੀ ਮੇਰੀ ਸ਼ਾਇਰੀ ਦੀ ਬੜੀ ਪ੍ਰਸ਼ੰਸਾ ਕਰਦੇ ਨੇ ਅਤੇ ਮੇਰੀ ਹੌਸਲਾ ਅਫਜ਼ਾਈ ਕਰਦੇ ਰਹਿੰਦੇ ਨੇ ਇਸੇ ਤਰ੍ਹਾਂ ਮੈਂ ਆਪਣੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕਰਦਾ ਰਹਿੰਦਾ ਉਹਨਾਂ ਨੂੰ ਵੀ ਚੰਗਾ ਲਿਖਣ ਲਈ ਪ੍ਰੇਰਿਤ ਕਰਦਾ ਰਹਿੰਦਾ ਮੈਨੂੰ ਲਿਖਣ ਦਾ ਵੀ ਸ਼ੌਕ ਹੈ ਅਤੇ ਮੈਨੂੰ ਚੰਗੀ ਰਾਈਟਿੰਗ ਵੀ ਬਹੁਤ ਪਸੰਦ ਹੈ ਜਿਹਨਾਂ ਵਿਦਿਆਰਥੀਆਂ ਦੀ ਰਾਈਟਿੰਗ ਵ ਵਧੀਆ ਹੁੰਦੀ ਹੈ ਉਹਨਾਂ ਦੀ ਰਾਈਟਿੰਗ ਦੇਖ ਕੇ ਇੱਕ ਪੌਸੀਟੀਵਿਟੀ ਆਉਂਦੀ ਹੈ ਅਤੇ ਉਹਨਾਂ ਦਾ ਲਿਖਣ ਲਿਖਿਆ ਹੋਇਆ ਲੇਖ ਵੀ ਪੜ੍ਹਨ ਨੂੰ ਜੀਅ ਕਰਦਾ ਜਿਹਨਾਂ ਵਿਦਿਆਰਥੀਆਂ ਦੀ ਰਾਈਟਿੰਗ ਹੈ ਜਿਹੜੀ ਬੇਕਾਰ ਹੁੰਦੀ ਹੈ ਉਸ ਨੂੰ ਲਿਖਨ ਪੜ੍ਹਨ ਨੂੰ ਵੀ ਦਿਲ ਨਹੀਂ ਕਰਦਾ ਇਸ ਲਈ ਮੈਂ ਚੰਗਾ ਲਿਖਣਾ ਚੰਗਾ ਬੋਲਣਾ ਅਤੇ ਚੰਗੀ ਸ਼ਾਇਰੀ ਵਗੈਰਾ ਦੀ ਬੱਚਿਆਂ ਨੂੰ ਵੀ ਸਲਾਹ ਦਿੰਦਾ ਅਤੇ ਆਪਣੇ ਵ ਦੋਸਤਾਂ ਮਿੱਤਰਾਂ ਨੂੰ ਵੀ ਸਲਾਹ ਦਿੰਦਾ ਅਤੇ ਮੈਂ ਵੀ ਖ਼ੁਦ ਵੀ ਇਸ 'ਤੇ ਅਮਲ ਕਰਦਾ